ਪੰਜਾਬ ਵਿੱਚ ਪੰਜਾਬੀ ਭਾਸ਼ਾ ਕਿਉਂਕਿ ਇਹਨੂੰ ਬੜਾ ਮਹੱਤਵ ਦਿੱਤਾ ਜਾਂਦਾ ਹੈ ਅਤੇ ਸਾਰਿਆਂ ਨੂੰ ਠੀਕ ਹੈ ਮਾਂ ਬੋਲੀ ਸਭ ਨੂੰ ਆਪਣੀ ਆਪਣੀ ਪਸੰਦ ਵੀ ਹੁੰਦੀ ਹੈ ਔਰ ਉਹਦਾ ਮਾਣ ਸਭ ਕਰਦੇ ਹੈ ਅਤੇ ਲੇਕਿਨ ਹੁਣ ਇਹ ਦੇਖਣ ਵਿੱਚ ਆਇਆ ਵਾ ਕਿ ਜਿਹੜੇ ਜਿਸ ਤਰਾਂ ਕੋਈ ਹਿੰਦੀ ਭਾਸ਼ੀ ਕੋਈ ਜਦੋਂ ਹੁੰਦੇ ਆ ਆਉਂਦੇ ਆ ਦੂਸਰੇ ਕੋਈ ਇੱਥੇ ਰਹਿਣ ਆਉਂਦੇ ਜਾਂ ਇੱਥੇ ਸਾਰਿਆਂ ਵਿੱਚ ਵਿਚਰਦੇ ਆ ਅਤੇ ਪੰਜਾਬੀ ਅਕਸਰ ਉਹਨੂੰ ਥੋੜ੍ਹਾ ਨੀਵੀਂ ਨਜ਼ਰ ਨਾਲ ਦੇਖਦੇ ਆ ਕਿ ਹਾਂ ਵੀ ਹਿੰਦੀ ਬੋਲਣ ਵਾਲੇ ਨੂੰ ਬਹੁਤਾ ਇੰਨਾ ਮਾਣ ਨਹੀਂ ਦੇ ਕੇ ਆਪਣੀ ਪੰਜਾਬੀ ਭਾਸ਼ਾ ਨੂੰ ਜ਼ਿਆਦਾ ਮੰਨ ਕੇ ਅਤੇ ਉਸ ਚੀਜ਼ ਦਾ ਤਾਂ ਉਹਦੇ 'ਤੇ ਅਸਰ ਪਾਉਂਦੇ ਆ ਅਤੇ ਲੈ ਦੇ ਕੇ ਦੇਖਿਆ ਜਾਂਦਾ ਕਿ ਜਿਹੜਾ ਹਿੰਦੀ ਭਾਸ਼ੀ ਕੋਈ ਬਾਹਰੋਂ ਆਉਂਦਾ ਹੋਵੇ ਅਤੇ ਉਹ ਕੁਛ ਟਾਈਮ ਬਾਅਦ ਆਪਣੇ ਆਪ ਨੂੰ ਇੱਥੇ ਸਟੇਬਲ ਕਰਨ ਵਾਸਤੇ ਉਹ ਵੀ ਕੁਛ ਮਿਕਸ ਜਿਹੀ ਪੰਜਾਬੀ ਬੋਲਣਾ ਸ਼ੁਰੂ ਕਰ ਦਿੰਦਾ ਬਾਕੀ ਅੰਗਰੇਜ਼ੀ ਬੋਲਣ ਵਾਲਿਆਂ ਵਾਸਤੇ ਵੀ ਕੋਈ ਬਹੁਤਾ ਜਿਹੜੇ ਪੁਰਾਣੇ ਪੰਜਾਬੀ ਹੈਗੇ ਆ ਉਹ ਇਤਨਾ ਉਹਨਾਂ ਨੂੰ ਪਸੰਦ ਨਹੀਂ ਕਰਦੇ ਅਤੇ ਉਸ ਸਮੇਂ ਦੇ ਇੱਕ ਸ਼ਾਇਦ ਸਾਡੀ ਪੰਜਾਬੀ ਭਾਸ਼ਾ ਉੱਤੇ ਇਹਨਾਂ ਦਾ ਕੋਈ ਖਤਰਾ ਮੰਡਰਾ ਰਿਹਾ ਸਾਡੀ ਭਾਸ਼ਾ ਨੂੰ ਕਰ ਖ਼ਤਮ ਕਰ ਦੇਣਾ ਚਾਹੁੰਦੇ ਆ ਜਿਹੜੇ ਨੇ ਕਿਉਂਕਿ ਪਬਲਿਕ ਸਕੂਲਾਂਂ ਵਿੱਚ ਤਾਂ ਹੁਣ ਇੰਗਲਿਸ਼ ਵੈਸੇ ਲਾਗੂ ਹੋ ਗਈ ਨਵੇਂ ਪਰਿਵਾਰਾਂ ਨੇ ਤਾਂ ਹੁਣ ਸਮੇਂ ਦੀ ਮਤਲਬ ਮੰਗ ਨੂੰ ਅਸੈਪਟ ਕਰ ਲਿਆ ਇੱਕ ਦੂਸਰੇ ਦੀ ਭਾਸ਼ਾ ਦਾ ਮਾਣ ਕਰਨਾ ਜ਼ਰੂਰੀ ਹੈ ਸਾਰੀਆਂ ਭਾਸ਼ਾਵਾਂ ਆਉਣੀਆਂ ਜ਼ਰੂਰੀ ਹੈ ਜੇ ਤਰੱਕੀ ਕਰਨੀ ਹੈ ਤਾਂ ਅਤੇ ਹਾਂ ਸ ਇਹ ਵੈ ਕਿ ਫਿਰ ਵੀ ਆਪਣੀ ਰਾਜ ਭਾਸ਼ਾ ਪੰਜਾਬੀ ਭਾਸ਼ਾ ਦਾ ਇਹ ਮਾਣ ਕਰਦਿਆਂ ਹੋਇਆ ਕਿਤੇ ਨਾ ਕਿਤੇ ਦੂਸਰੀਆਂ ਭਾਸ਼ਾਵਾਂ ਨੂੰ ਥੋੜ੍ਹਾ ਇਸ ਦੂਜੇ ਦਰਜੇ ਉੱਤੇ ਮ ਬਣਾਇਆ ਜਾਂਦਾ ਹੈ